ਹੈਲੋ ਹਾਂਜੀ ਜੇ ਆਪਾਂ ਭੰਗੜੇ ਦੇ ਸਟੈਪਾਂ ਦੀ ਗੱਲ ਕਰੀਏ ਵੈਸੇ ਤਾਂ ਬਹੁਤ ਜ਼ਿਆਦਾ ਹੈ ਨਾ ਭੰਗੜਿਆਂ ਦੇ ਸਟੈਪ ਹੁੰਦੇ ਜਿਹੜੇ ਅੱਜ ਕੱਲ੍ਹ ਮੁੰਡੇ ਕਰਦੇ ਹੈਗੇ ਆ ਹੈ ਨਾ ਤਾਂ ਭੰਗੜਾ ਵੈਸੇ ਖੂਬਸੂਰਤ ਹੁੰਦਾ ਹੈਗਾ ਪਾਉਂਦਾ ਵੇਖਣਾ ਹਰ ਲੋਕ ਲਾਇਕ ਕਰਦੇ ਹੈ ਔਰ ਦੇਖਣਾ ਵੀ ਪਸੰਦ ਹੈ ਹੈ ਨਾ ਸਾਰਿਆਂ ਨੂੰ ਤਾਂ ਕਈ ਜਿਹੜੇ ਕਿ ਭੰਗੜੇ ਦੇ ਸਟੈਪ ਹੁੰਦੇ ਹੈ ਬਹੁਤ ਹੀ ਜ਼ਿਆਦਾ ਜੋਰਦਾਰ ਹੁੰਦੇ ਆ ਹੈ ਨਾ ਜਿਵੇਂ ਕਿ ਅੱਜ ਕੱਲ੍ਹ ਦੇ ਮੁੰਡੇ ਹੈਗੇ ਹੈਗੇ ਅਤੇ ਉਹ ਇੱਕ ਲੱਤ 'ਤੇ ਭੰਗੜਾ ਪਾਉਂਦੇ ਹੈਗੇ ਆ ਇੱਕ ਲੱਤ 'ਤੇ ਭੰਗੜਾ ਪਾਉਂਦੇ ਹੈਗੇ ਆ ਅਤੇ ਉਹ ਬਹੁਤ ਹੀ ਜ਼ਿਆਦਾ ਜੋਰਦਾਰ ਸਟੈਪ ਹੁੰਦਾ ਹੈ ਨਾ ਅਤੇ ਇਹੋ ਜਿਹੇ ਕਈ ਸਟੈਪਾਂ ਨੂੰ ਵੇਖਣ ਲਈ ਲੋਕ ਜਿਹੜੇ ਕਿ ਦੂਰ ਦੂਰ ਤੋਂ ਆਉਂਦੇ ਹੈਗੇ ਆ ਹੈ ਨਾ ਅਤੇ ਵਧੀਆ ਵਧੀਆ ਲੱਗਦਾ ਹੈਗਾ ਗਾ ਇਹਨਾਂ ਨੂੰ ਲੋਕ ਲਾਈਕ ਕਰਦੇ ਦੂਰ ਦੂਰ ਤੋਂ ਲੋਕ ਵੇਖਣ ਆਉਂਦੇ ਹੈਗੇ ਆ ਭੰਗੜੇ ਨੂੰ ਇੱਦਾਂ ਦੇ ਕਈ ਹੋਰ ਸਟੈਪ ਵੀ ਹੁੰਦੇ ਹੈਗੇ ਆ ਜਿਹੜੇ ਕਿ ਬਹੁਤ ਜ਼ਿਆਦਾ ਫੇਮਸ ਹੁੰਦੇ ਆ ਜਿਵੇਂ ਇੱਕ ਲੱਤ ਦਾ ਭੰਗੜਾ ਹੋ ਗਿਆ ਔਰ ਜੋ ਕਿ ਮੰਨ ਕੇ ਚੱਲੋ ਵੀ ਬੈਠ ਕੇ ਉਠਦੇ ਹੈਗੇ ਆ ਹੈ ਨਾ ਜਿੱਦਾਂ ਭੰਗੜਾ ਆਉਂਦਾ ਇੱਦਾਂ ਅ ਸਟੈਪ ਦਾ ਨਹੀਂ ਉਹ ਹੈਗਾ ਮੈਨੂੰ ਤਾਂ ਵਧੀਆ ਲੱਗਦਾ ਹੈਗਾ ਜਦੋਂ ਬਸ ਮੈਂ ਮੈਨੂੰ ਵਧੀਆ ਲੱਗਦਾ ਬਾਕੀ ਹੋਰ ਵੀ ਕਈ ਲੋਕ ਜਿਹੜੇ ਕਿ ਭੰਗੜੇ ਨੂੰ ਦੇਖਣ ਲਈ ਆਉਂਦੇ ਹੈਗੇ ਆ ਤਾਂ ਬਹੁਤ ਵਧੀਆ ਲੱਗਦਾ ਭੰਗੜਾ ਬਸ